ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਲਾਂ ਦੌਰਾਨ ਭਾਰਤੀ ਮਨੋਰੰਜਨ ਉਦਯੋਗ ਦਾ ਵਿਕਾਸ ਬਹੁਤ ਹੀ ਤਰੱਕੀ ਨਾਲ ਹੋ ਰਿਹਾ ਹੈ ਜਿਸ ਨਾਲ ਦੇਸ਼ ਵਿੱਚ ਅਲੱਗ ਅਲੱਗ ਪ੍ਰਸਿੱਧ ਮਨੋਰੰਜਨ ਦੇ ਸਾਧਨ ਬਣ ਗਏ ਹਨ ਜਿਵੇਂ ਕਿ ਲੋਕ ਤਮਾਸ਼ੇ ਲੋਕ ਨਾਚ ਲੋਕ ਮੇਲੇ ਲੋਕ ਸਾਜ ਅਤੇ ਲੋਕ ਸਾਹਿਤ ਸਾਹਿਤ ਲੋਕ ਤਮਾਸ਼ਿਆਂ ਨੂੰ ਲੋਕ ਦੇਖਣਾ ਬਹੁਤ ਹੀ ਪਸੰਦ ਕਰਦੇ ਹਨ ਜਿਸ ਵਿੱਚ ਲੋਕ ਬਾਂਦਰ ਬਾਂਦਰੀਆਂ ਦਾ ਨਾਚ ਅਤੇ ਕਈ ਸਾਰੇ ਹੋਰ ਵੀ ਤਮਾਸ਼ੇ ਦੇਖਦੇ ਹਨ ਲੋਕ ਨਾਚ ਦਾ ਪ੍ਰਸਿੱਧ ਪੰਜਾਬ ਦਾ ਗਿੱਦਾ ਭੰਗੜਾ ਅਤੇ ਲੁੱਡੀ ਵਗੈਰਾ ਬਹੁਤ ਸਾਰੇ ਨਾਚ ਹਨ ਜਿਸਨੂੰ ਲੋਕ ਬਹੁਤ ਹੀ ਪਸੰਦ ਕਰਦੇ ਹਨ ਲੋਕ ਤਾਂ ਮੇਲਿਆਂ ਵਿੱਚ ਜਾਣਾ ਵੀ ਬਹੁਤ ਪਸੰਦ ਕਰਦੇ ਹਨ ਜੋ ਕਿ ਲੋਕਾਂ ਨੂੰ ਬਹੁਤ ਹੀ ਪਸੰਦ ਹੈ ਭਾਰਤ ਨੂੰ ਮੇਲਿਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ ਲੋਕ ਸਾਜ ਲੋਕ ਅਪ ਆਪਣੇ ਦੇਸ਼ ਵਿੱਚ ਕਈ ਸਾਰੇ ਸਾਜ ਵੀ ਪਾਏ ਜਾਂਦੇ ਹਨ ਜੋ ਕਿ ਲੋਕਾਂ ਨੂੰ ਵਜਾਉਣਾ ਅਤੇ ਸੁਣਨਾ ਬਹੁਤ ਹੀ ਪਸੰਦ ਆਉਂਦਾ ਹੈ ਜਿਵੇਂ ਕਿ ਢੋਲ ਚਿਮਟਾ ਆਦਿ ਲੋਕ ਤਾਂ ਕਈ ਤਰ੍ਹਾਂ ਦੀਆਂ ਖੇਡਾਂ ਵੀ ਖੇਡਦੇ ਹਨ ਮਨੋਰੰਜਨ ਲਈ ਇਹ ਜਿਵੇਂ ਕਿ ਕਬੱਡੀ ਹਾਕੀ ਆਦਿ ਜਿਸ ਨਾਲ ਜੋ ਕਿ ਲੋਕਾਂ ਨੂੰ ਬਹੁਤ ਹੀ ਪਸੰਦ ਹੈ ਲੋਕ ਇਸ ਕਿਸ ਕਿਸਮ ਦੀ ਲੋਕ ਮੇਲਿਆਂ ਵਿੱਚ ਜਾ ਕੇ ਬਹੁਤ ਤਰ੍ਹਾਂ ਦੇ ਪਕਵਾਨ ਵੀ ਖਾਂਦੇ ਹਨ ਉਹਨਾਂ ਨੂੰ ਬਹੁਤ ਹੀ ਪਸੰਦ ਹੁੰਦੇ ਹਨ ਇਹ ਭਾਰਤ ਦੇ ਮਨੋਰੰਜਨ ਵਿਕਾਸ ਦਾ ਸਭ ਤੋਂ ਵੱਡਾ ਵਿਕਾਸ ਹੈ